ਪਹਾੜ ਦੀ ਚੜ੍ਹਾਈ ਨ ਚੜ੍ਹਨ ਤੋਂ ਪਹਿਲਾਂ ਸਰੀਰ ਦੇ ਸਾਰੇ ਅੰਗਾਂ ਦੀ ਕਸਰਤ ਜ਼ਰੂਰੀ ਹੈ ਅਤੇ ਜਿਵੇਂ ਕਿ ਇਹ ਪਹਾੜ ਦੀ ਚੜ੍ਹਾਈ ਚੜ੍ਹਨ ਵਿੱਚ ਸਾਡੇ ਸਾਰੇ ਸਰੀਰ ਦਾ ਹੀ ਯੋਗਦਾਨ ਹੈ ਹਰ ਇੱਕ ਅੰਗ ਦਾ ਹੀ ਅਤੇ ਸਾਰੇ ਅੰਗਾਂ ਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਹੁੰਦੀ ਹੈ ਅਤੇ ਸਾਰੇ ਤਾਂ ਇਸ ਕਰਕੇ ਆਪਾਂ ਨੂੰ ਸਾਰੇ ਅੰਗਾਂ ਦੀਆਂ ਹੀ ਕਰਨੀ ਚਾਹੀਦੀਆਂ ਜਿੱਦਾਂ ਆਪਾਂ ਸਾਹ ਪਕਾਉਣ ਤੋਂ ਸਟਾਰਟ ਕਰ ਸਕਦੇ ਹਾਂ ਜਿਵੇਂ ਸਾਹ ਪਕਾਉਣ ਦੀ ਲੋੜ ਹੁੰਦੀ ਆਪਾਂ ਲਗਾਤਾਰ ਚੜ੍ਹਾਈ ਚੜ੍ਹਨੀ ਹੈ ਤਾਂ ਉਹਦੇ ਵਿੱਚ ਸਾਨੂੰ ਸਾਹ ਚੜੀ ਜਾਵੇਗਾ ਤਾਂ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈ ਜਾਂਦਾ ਇਸ ਕਰਕੇ ਆਪਾਂ ਇਹ ਦੌੜ ਲਗਾ ਸਕਦੇ ਹਾਂ ਪੀ ਟੀ ਡਰਿੱਲਾਂ ਦੀਆਂ ਕਾਫ਼ੀ ਕਸਰਤਾਂ ਕਰ ਸਕਦੇ ਹਾਂ ਅਤੇ ਆਪਾਂ ਇਹ ਇਹ ਸਪ੍ਰਿੰਟਾਂ ਲਗਾ ਸਕਦੇ ਹਾਂ ਲੰਬੀਆਂ ਦੌੜਾਂ ਵਗੈਰਾ ਤੁਹਾਨੂੰ ਭੱਜ ਸਕਦੇ ਹਾਂ ਤੇ ਉਹਦੇ ਵਿੱਚ ਸਾਡਾ ਸਾਹ ਵੀ ਪੱਕੇਗਾ ਅਤੇ ਆਪਣੀਆਂ ਲੱਤਾਂ ਵੀ ਮਜ਼ਬੂਤ ਹੁੰਦੀਆਂ ਹਨ ਅਤੇ ਉਹਨਾਂ ਦੀਆਂ ਮਾਸਪੇਸ਼ੀਆਂ ਜਿਵੇਂ ਸਹੀ ਬਣਦੀਆਂ ਹਨ ਤਾਂ ਉਹ ਉਹਦੇ ਕਰਕੇ ਫਿਰ ਉਹ ਸਾਨੂੰ ਉਹ ਕਾਫ਼ੀ ਲਾਭਦਾਇਕ ਹੁੰਦੀ ਹੈ ਅਤੇ ਆਪਾਂ ਫਿਰ ਉਹਦੇ ਕਰਕੇ ਲੰਬੇ ਟਾਈਮ ਲਈ ਤੁਰਦੇ ਹਾਂ ਲੰਬੇ ਟਾਈਮ ਲਈ ਚੜ੍ਹਾਈ ਚੜ੍ਹਦੇ ਹਾਂ ਤਾਂ ਕੋਈ ਦਿੱਕਤ ਪਰੇਸ਼ਾਨੀ ਬਹੁਤੀ ਆਉਂਦੀ ਨਹੀਂ ਹੈਗੀ ਅਤੇ ਜਿਵੇਂ ਸਾਹ ਨਹੀਂ ਚੜ੍ਹਦਾ ਬਹੁਤਾ ਅਤੇ ਸਾਡੀਆਂ ਲੱਤਾਂ ਨਹੀਂ ਥੱਕਦੀਆਂ ਸਰੀਰ ਜ਼ਿਆਦਾ ਛੇਤੀ ਥੱਕਦਾ ਨਹੀਂ ਹੈਗਾ ਇਸ ਕਰਕੇ ਸਾਨੂੰ ਇਹ ਜਿਹੜੀਆਂ ਸਾਹ ਪਕਾਉਣ ਵਾਲੀਆਂ ਕਸਰਤਾਂ ਆ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਹਦੇ ਵਿੱਚ ਕਰਨੀਆਂ ਅਤੇ ਇਹ ਹੋਰ ਹੋਰ ਜਿਵੇਂ ਆਪਾਂ ਆਪਣੇ ਮੋਡਿਆਂ ਮੂੰਡਿਆਂ ਨੂੰ ਵੀ ਪੂਰਾ ਉਸ ਸਟਰੋਂਗ ਰੱਖਣਾ ਹੈਗਾ ਆਪਾਂ ਜਿਵੇਂ ਕੋਈ ਰੱਸਾ ਰੁੱਸਾ ਫੜ੍ਹ ਕੇ ਪਹਾੜ ਚੜ੍ਹ ਰਹੇ ਹਾਂ ਸਾਡੇ ਹੱਥ ਨਾ ਬਾਹਾਂ ਨਾ ਥੱਕਣ ਤਾਂ ਇਸ ਕਰਕੇ ਸਾਨੂੰ ਲਗਭਗ ਸਾਰੇ ਹੀ ਸਰੀਰ ਦੇ ਅੰਗਾਂ ਦੀ ਕਸਰਤ ਕਰ ਲੈਣੀ ਚਾਹੀਦੀ ਹੈ